ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ

ਦੇਖਿਆ ਮੈਂ ਥੋੜ੍ਹਾ ਟਾਈਮ ਜਿਹਾ ਨਹੀਂ ਲੱਗਦਾ ਅਸਲ 'ਚ ਘਰ ਗੈਸਟ ਆਏ ਵੇ ਦੇਖਿਆ ਤਾਂ ਹੈਗਾ ਫਿਰ ਦੇਖਿਆ ਕੁਛ ਤਾਂ ਹਾਂ ਹਾਂ ਹਾਂ ਹਾਂ ਬਹੁਤ ਆ ਪੰਜਾਬ 'ਚ ਹੈਗੇ ਤਾਂ ਬੜੇ ਬੜੇ ਵਧੀਆ ਨੇ ਬਸ ਪੰਜਾਬੀਆਂ ਨੂੰ ਜ਼ਿਆਦਾ ਪਿੱਛੇ ਰੱਖਿਆ ਜਾਂਦਾ ਪੰਜਾਬੀ ਹੈਗੇ ਤਾਂ ਬੜੇ ਅੱਗੇ ਛਲਾਂਗਾ ਮਾਰਦੇ ਨੇ ਕਾਫੀ ਫੇਮਸ ਹੈ ਕਾਫੀ ਜ਼ਿਆਦਾ ਨੇ ਹੈ ਨਾ ਜਿਵੇਂ ਤੁਸੀਂ ਲਾ ਲਓ ਇਸ ਤਰ੍ਹਾਂ ਅਤੇ ਜੇ ਐਕਟਰਸ ਦਾ ਲਾਓ ਤਾਂ ਧਰਮਿੰਦਰ ਕਾਫੀ ਫੇਮਸ ਹੈ ਪਹਿਲੇ ਜੀ ਅਰਸ਼ੈ ਕੁਮਾਰ ਵੀ ਸੀ ਆ ਸਿੰਗਰ ਲਾ ਲਓ ਤਾਂ ਸ਼ੈਰੀ ਮਾਨ ਬੜੇ ਨੰਬਰ 'ਤੇ ਆ ਗੁਰਦਾਸ ਮਾਨ ਆ ਇਹ ਦਿਲਜੀਤ ਦੁਸਾਂਝ ਹੈ ਹਾਂ ਹਾਂ ਕਪਿਲ ਦਾ ਹਾਂ ਕਪਿਲ ਦਾ ਤਾਂ ਕਮਾਲ ਦਾ ਵਾਕਿਆ ਹੀ ਕਮਾਲ ਦਾ ਹੁੰਦਾ ਹੈ ਦਿਲਜੀਤ ਦੁਸਾਂਝ ਹੈ ਬੜੇ ਕਾਫੀ ਜਾ ਰਹੇ ਹਾਂ ਹਾਂ ਹਾਂ ਸਿੱਧੂ ਮੂਸੇਵਾਲਾ ਵੀ ਗਿਆ ਸੀਗਾ ਬਾਲੀਵੁੱਡ 'ਚ ਹੈ ਨਾ ਸਿੱਧੂ ਮੂਸੇਵਾਲਾ ਦਾ ਬੜਾ ਬੜਾ ਚਰਚਾ ਹਾਂ ਹਾਂ ਬਹੁਤ ਜ਼ਿਆਦਾ ਫੇਮਸ ਹੈ ਕਾਫੀ ਹੈਗੇ ਨੇ ਹੋਰ ਵੀ ਹੈ ਨਾ ਹਾਂ ਪੰਜਾਬ ਦੇ ਮਾਣ ਵਾਲੀ ਗੱਲ ਹੁੰਦੀ ਆ ਸਾਡੇ ਪੰਜਾਬ ਦੇ ਪੰਜਾਬ ਦੇ ਨੇ ਹੈ ਨਾ ਹਾਂ ਹਾਂ ਹਾਂ ਵਧੀਆ ਲੱਗਦਾ ਹਾਂ ਹਾਂ ਹਾਂ ਜਦੋਂ ਕੋਈ ਗੱਲ ਫਿਰ ਤਾਂ ਪੰਜਾਬੀ ਆ ਹਾਂ ਠੀਕ ਠਾਕ ਵਧੀਆ ਠੀਕ ਠਾਕ ਹੈ ਹੋਰ ਘਰ ਠੀਕ ਠਾਕ ਠੀਕ ਠੀਕ ਓਕੇ ਸਤਿ ਸ਼੍ਰੀ ਅਕਾਲ